ਸਤਿ ਸ਼੍ਰੀ ਅਕਾਲ ਸਰ ਸਰ ਮੈਂ ਪਠਾਨਕੋਟ ਦਾ ਰਹਿਣ ਵਾਲਾ ਵਿਦਿਆਰਥੀ ਹੈਗਾ ਅਤੇ ਜਿਵੇਂ ਕਿ ਮੈਂ ਗੱਲ ਕਰਾਂ ਕਿ ਸਕੂਲ ਕੋਲੇਜਾਂ ਬਾਰੇ ਅਤੇ ਸਾਡੇ ਸਾਡੇ ਜਿਹੜੇ ਸ਼ਹਿਰ ਵਿੱਚ ਜਿਹੜੇ ਪੰਜ ਛੇ ਸਕੂਲ ਹੈਗੇ ਇਹ ਬੜੇ ਹੀ ਮਸ਼ਹੂਰ ਹੈਗੇ ਆ ਜਿੱਦਾਂ ਸ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਕੂਲ ਹੈਗਾ ਇੱਥੇ ਉਹ ਵੀ ਬੜਾ ਵਧੀਆ ਹੈਗਾ ਅਤੇ ਜਿੱਦਾਂ ਏ ਬੀ ਕੋਲੇਜ ਹੈਗਾ ਅਤੇ ਐਸ ਡੀ ਐਮ ਸਕੂਲ ਹੈਗਾ ਅਮਨ ਭੱਲਾ ਸਕੂਲ ਹੈਗਾ ਅਤੇ ਉਹ ਕੋਲੇਜ ਹੈਗਾ ਅਤੇ ਇਹ ਕੋਲੇਜਾਂ ਵਿੱਚ ਬੜੇ ਹੀ ਉਹ ਖੇਡਾਂ ਵੀ ਹੁੰਦੀ ਹੈਗੀਆਂ ਅਤੇ ਹੋਰ ਵੀ ਕੋਈ ਵੀ ਪ੍ਰੋਗਰਾਮ ਜਿਹੜੇ ਹੁੰਦੇ ਹੈਗੇ ਆ ਉਹ ਵੀ ਬੜੇ ਵਧੀਆ ਹੁੰਦੇ ਹੈਗੇ ਆ ਅਤੇ ਜਿਹੜੇ ਟੀਚਰ ਹੈਗੇ ਆ ਇਹ ਵੈੱਲ ਐਜੂਕੇਟਿਡ ਹੈਗੇ ਆ ਅਤੇ ਧੰਨਵਾਦ